ਪੁਰਾਣੇ ਸਮੇਂ ਦੇ ਵਿੱਚ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ ਸੜਕਾਂ ਸ ਬਿਲਕੁਲ ਕੱਚੀਆਂ ਸੀਗੀਆਂ ਆਵਾਜਾਈ ਦੇ ਸਾਧਨਾਂ ਵਾਸਤੇ ਆਮ ਤੌਰ 'ਤੇ ਟਾਂਗਾ ਅਤੇ ਸਾਈਕਲ ਰਿਕਸ਼ਾ ਰੇਹੜਾ ਆਮ ਤੌਰ 'ਤੇ ਵਰਤੋਂ 'ਚ ਆਉਂਦੇ ਸਨ ਸੜਕਾਂ ਜਿਹੜੀਆਂ ਸੀਗੀਆਂ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਕੱਚੀਆਂ ਸੜਕਾਂ ਸਨ ਬੱਸ ਵੀ ਕੋਈ ਬਹੁਤ ਘੱਟ ਆਉਂਦੀ ਸੀ ਜੇ ਆਉਂਦੀ ਸੀ ਤਾਂ ਬਹੁਤ ਭਰੀ ਹੁੰਦੀ ਸੀ ਉਹਦੇ ਉੱਤੇ ਤੱਕ ਚੜ੍ਹ ਕੇ ਜਾਣਾ ਪੈਂਦਾ ਸੀ ਅਤੇ ਉਹ ਫਿਰ ਖੋ ਟੋਏ ਖੱਡੇ ਵੀ ਸੜਕ 'ਤੇ ਨਹੀਂ ਦੇਖਦੀ ਸੀ ਕਿਸੇ ਦੇ ਸੱਟ ਵੀ ਲੱਗ ਜਾਣੀ ਤਾਂ ਬੱਸ ਵਾਲੇ ਨੂੰ ਕੋਈ ਇਹਦੀ ਪਰਵਾਹ ਨਹੀਂ ਸੀ ਹੁੰਦੀ ਜਿਹੜੀਆਂ ਟ੍ਰੇਨਾਂ ਵੀ ਸੀ ਉਹ ਵੀ ਬਹੁਤ ਘੱਟ ਸਨ ਅਤੇ ਉਹਨਾਂ ਦੀ ਜਿਹੜੀ ਪਹੁੰਚ ਸੀ ਉਹ ਵੱਡੇ ਸ਼ਹਿਰਾਂ ਤੱਕ ਸੀਮਿਤ ਸੀ ਛੋਟੇ ਸ਼ਹਿਰਾਂ ਦੇ ਵਿੱਚ ਟ੍ਰੇਨ ਅੱਬਲ ਹੈ ਤਾਂ ਲਾਇਨ ਨਹੀਂ ਸੀ ਜੇ ਲਾਈਨ ਨਹੀਂ ਸੀ ਨਹੀਂ ਸੀਗੀ ਤਾਂ ਟ੍ਰੇਨ ਕੋਈ ਰੁਕਦੀ ਵੀ ਨਹੀਂ ਸੀ ਉੱਥੇ ਜੇਕਰ ਹੁਣ ਦੀ ਗੱਲ ਕਰੀਏ ਹੁਣ ਥੋੜ੍ਹਾ ਜਿਹਾ ਜ਼ਮਾਨਾ ਅੱਗੇ ਨਾਲੋਂ ਠੀਕ ਹੈ ਸੜਕਾਂ ਜਿਹੜੀਆਂ ਉਹ ਵਧੀਆ ਬਣ ਗਈਆਂ ਨੇ ਮੋਟਰਸਾਈਕਲ ਆ ਗਿਆ ਮੋਟਰਸਾਈਕਲ 'ਤੇ ਵੀ ਇੱਕ ਬੜੀ ਔਖ ਆਉਂਦੀ ਆ ਉਹ 'ਤੇ ਦੋ ਬੰਦੇ ਬੈਠ ਸਕਦੇ ਆ ਸਕੂਟਰ ਇਸ ਤਰ੍ਹਾਂ ਉਹ 'ਤੇ ਵੀ ਦੋ ਬੰਦੇ ਸ ਬਹਿ ਸਕਦੇ ਜਦ ਤੀਆ ਬੰਦਾ ਬਹਿੰਦਾ ਤਾਂ ਉਹਦਾ ਚਲਾਨ ਹੁੰਦਾ ਕਾਰਾਂ ਨੇ ਜਿਹੜੀਆਂ ਕਾਰ ਦੇ ਵਿੱਚ ਚਲੋ ਐਨਾ ਪੰਜ ਬੰਦੇ ਬਹਿ ਸਕਦੇ ਆ ਚਲੋ ਕਿਤੇ ਪੰਜ ਬੰਦੇ ਪਰਿਵਾਰ ਦੇ ਇਕੱਠੇ ਹੋ ਕੇ ਜਾ ਸਕਦੇ ਨੇ ਬੱਸਾਂ ਜਿਹੜੀਆਂ ਉਹਨਾਂ ਦੀ ਹਾਲਤ ਵੀ ਹੁਣ ਅੱਗੇ ਨਾਲੋਂ ਕਾਫੀ ਸੁਧਰ ਗਈ ਹੈ ਪਰ ਜਿਹੜਾ ਕਿਰਾਇਆ ਬੱਸਾਂ ਏ ਸੀ ਤੱਕ ਤਾਂ ਮ ਉਪਲਬਧ ਹਨ ਪਰ ਉਹਦਾ ਕਿਰਾਇਆ ਐਨਾ ਜ਼ਿਆਦਾ ਹੋ ਗਿਆ ਕਿ ਆਮ ਬੰਦੇ ਵਾਸਤੇ ਮਹਿੰਗਾਈ 'ਚ ਚੜ੍ਹਨਾ ਬੜਾ ਮੁਸ਼ਕਲ ਹੋ ਗਿਆ ਸ਼ਹਿਰਾਂ ਦੇ ਵਿੱਚ ਆਟੋ ਰਿਕਸ਼ੇ ਬਹੁਤ ਆ ਗਏ ਨੇ ਉਹਨਾਂ ਨੇ ਰਿਕਸ਼ਿਆਂ ਦਾ ਕੰਮ ਜੋ ਬਿਲਕੁਲ ਜਿਹੜੇ ਦਿਹਾੜੀਦਾਰ ਬੰਦੇ ਪ੍ਰਭਾਵਿਤ ਕਰਤਾ ਟ੍ਰੇਨਾਂ ਵੀ ਜਿਹੜੀਆਂ ਹੈਗੀਆਂ ਨੇ ਟ੍ਰੇਨ ਦਾ ਕਿਰਾਇਆ ਵੀ ਅੱਗੇ ਨਾਲੋਂ ਬਹੁਤ ਵੱਧ ਚੁੱਕਿਆ ਅਤੇ ਛੋਟੇ ਸ਼ਹਿਰਾਂ ਤੱਕ ਹਜੇ ਵੀ ਟ੍ਰੇਨ ਨਹੀਂ ਪਹੁੰਚੀ ਹਾਂ ਵੱਡੇ ਸ਼ਹਿਰਾਂ ਤੱਕ ਜ਼ਰੂਰ ਥੋੜ੍ਹੀਆਂ ਸਹੂਲਤਾਂ ਵੱਧ ਨੇ ਉੱਥੇ ਤਾਂ ਮੈਟਰੋ ਤੱਕ ਵੀ ਆ ਗਈ ਹੈ ਜਹਾਜ਼ ਜਿਹੜਾ ਜਹਾਜ਼ਾਂ ਦੇ ਵੀ ਕਾਫੀ ਅੱਡੇ ਹੋ ਗਏ ਨੇ ਜਾਂ ਹਵਾਈ ਜਹਾਜ਼ਾਂ ਹਵਾਈ ਜਹਾਜ਼ਾਂ ਦੇ ਅਤੇ ਉਹਦੇ ਨਾਲ ਥੋੜ੍ਹਾ ਜਿਹਾ ਸੁ ਸੁੱਖ ਦਾ ਸਾਹ ਜਿਹੜਾ ਆਇਆ ਆਵਾਜਾਈ ਵਾਸਤੇ ਅਤੇ ਇਹੀ ਸਾਡੇ ਜੀਵਨ 'ਤੇ ਇਹਦਾ ਪ੍ਰਭਾਵ ਪਿਆ